ਭੰਗੜਾ ਐਰੋਬਿਕ ਬਹੁਤ ਤਰੀਕਿਆਂ ਨਾਲ ਵਿਅਕਤੀ ਨੂੰ ਆਪਣੀ ਸੱਭਿਆਚਾਰ ਵਿਰਾਸਤ ਨੂੰ ਅਪਣਾਉਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ ਜਦੋਂ ਮੈਂ ਆਪਣੇ ਘਰ ਬੱਚਿਆਂ ਨੂੰ ਕਰਪੋ ਅਰੋਬਿਕਸ ਭੰਗੜਾ ਕਰਦੇ ਦੇਖਦੀ ਹਾਂ ਤਾਂ ਮੇਰਾ ਮਨ ਬੜਾ ਖੁਸ਼ ਹੁੰਦਾ ਹੈ ਉਹ ਜਦੋਂ ਨੱਚਦੇ ਗਾਉਂਦੇ ਭੰਗੜਾ ਪਾਉਂਦੇ ਹਨ ਤਾਂ ਮੈਂ ਵੀ ਬੜੀ ਖੁਸ਼ ਹੁੰਦੀ ਹਾਂ ਅਤੇ ਮੇਰੇ ਪੋਤੇ ਪੋਤੀਆਂ ਮੈਨੂੰ ਕਹਿੰਦੇ ਨੇ ਕਿ ਆ ਦਾਦੀ ਤੁਸੀਂ ਵੀ ਭੰਗੜਾ ਪਾਓ ਪਰ ਮੈਂ ਵੀ ਮੈਂ ਫਿਰ ਮੈਂ ਪਹਿਲਾਂ ਮੈਨੂੰ ਝਾਕਾ ਹੁੰਦਾ ਸੀ ਹੁਣ ਮੈਨੂੰ ਝਾਕਾ ਨਹੀਂ ਹੁੰਦਾ ਕਿ ਮੈਂ ਵੀ ਵਿੱਚ ਥੋੜ੍ਹਾ ਜਿਹਾ ਭੰਗੜਾ ਪਾ ਆਉਂਦੀ ਆਹਾਂ ਭੰਗੜਾ ਪਾਉਣ ਨਾਲ ਮੇਰੀ ਫਿਟਨੈਸ 'ਤੇ ਬੜਾ ਫ਼ਰਕ ਪਿਆ ਹੈ ਅਤੇ ਮੈਂ ਫਿਰ ਹੋਰ ਵੀ ਆਪਣੇ ਘਰਦੇ ਕੰਮ ਕਰ ਲੈਂਦੀ ਹਾਂ ਫੁਰਤੀਲੀ ਹੋ ਗਈ ਹਾਂ ਅਤੇ ਬੱਚੇ ਵੀ ਬੜੇ ਖੁਸ਼ ਹੁੰਦੇ ਨੇ ਆਂਡ ਗਵਾਂਡ ਵੀ ਸਾਡੇ ਕਈ ਜਵਾਨ ਬੱਚੇ ਭ ਭੰਗੜਾ ਅਰੋਬਿਕਸ ਕਰਨ ਜਾਂਦੇ ਹਨ ਤਾਂ ਅੱਜ ਕੱਲ੍ਹ ਦਾ ਬੱਚਿਆਂ ਨੂੰ ਬੜਾ ਸ਼ੌਂਕ ਹੈ ਭੰਗੜੇ ਦਾ ਅਤੇ ਉਹ ਭੰਗੜਾ ਪਾਉਂਦੇ ਹਨ ਭੰਗੜਾ ਸਾਡੀ ਸਾਡੇ ਵਿ ਸਾਡੇ ਐਰੋਬਿਕਸ ਲਈ ਯੋਗ ਆਰੋਬਿਕਸ ਲਈ ਬੜਾ ਆਰੋਬਿਕਸ ਦੇ ਐਰੋਬਿਕਸ ਭੰਗੜਾ ਬਹੁਤ ਹੀ ਅੱਛਾ ਅ ਹੈ ਯੋਗਦਾਨ ਦਿੰਦਾ ਹੈ ਅਤੇ ਸਾਨੂੰ ਸਭ ਨੂੰ ਭੰਗੜਾ ਪਾਉਣਾ ਚਾਹੀਦਾ ਹੈ ਅਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹਦੇ ਨਾਲ ਸਾਡੇ ਸਰੀਰ ਨੂੰ ਫਿਟਨਸ ਮਿਲੇ ਧੰਨਵਾਦ